ਉੱਦਾਂ ਤਾਂ ਸਾਨੂੰ ਪੰਛੀਆਂ ਦੇ ਬਹੁਤ ਸਾਰੇ ਵਿਵਹਾਰ ਦੇਖਣ ਨੂੰ ਮਿਲਦੇ ਹਨ ਉਹ ਜਿਹੜੇ ਪੰਛੀ ਨੇ ਉਹ ਆਕਾਸ਼ ਵਿੱਚ ਉੱਡਦੇ ਨੇ ਅਤੇ ਇਕੱਠੇ ਲੈ ਕੇ ਉੱਡਦੇ ਨੇ ਹਮੇਸ਼ਾ ਸਮੂਹ 'ਚ ਰਹਿੰਦੇ ਨੇ ਅਗਰ ਅਸੀਂ ਦਾਣਾ ਪਾਈਏ ਤਾਂ ਵੀ ਉਹ ਇਕੱਠੇ ਚੁਗਣ ਆਂਉਦੇ ਨੇ ਉਹਨਾਂ ਤੋਂ ਸਾਨੂੰ ਇਹ ਹੀ ਸ਼ਿਕਸ਼ਾ ਮਿਲਦੀ ਹੈ ਪੰਛੀਆਂ ਤੋਂ ਕਿ ਸਾਨੂੰ ਵੀ ਇਕੱਠੇ ਹੀ ਰਹਿਣਾ ਚਾਹੀਦਾ ਹੈ ਤਾਂ ਕਿ ਮੁਸੀਬਤ ਵੇਲੇ ਜਿੱਦਾਂ ਉਹ ਮੁਸੀਬਤ ਵੇਲੇ ਪੰਛੀ ਸਾਰੇ ਇਕੱਠੇ ਹੋ ਜਾਂਦੇ ਨੇ ਇੱਕ ਪੰਛੀ ਨੂੰ ਮੁਸੀਬਤ ਆਵੇ ਸਾਰੇ ਚਾਂ ਚਾਂ ਕਰਦੇ ਕਰਦੇ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਣਗੇ ਉਹਨੂੰ ਵੇਖਣ ਵਾਸਤੇ ਅਤੇ ਸਾਨੂੰ ਵੀ ਇਨਸਾਨਾਂ ਨੂੰ ਏ ਇਹ ਹੀ ਸ਼ਿਕਸ਼ਾ ਮਿਲਦੀ ਉਹਨਾਂ ਤੋਂ ਵੀ ਸਾਨੂੰ ਵੀ ਇਕੱਠੇ ਹੀ ਰਹਿਣਾ ਚਾਹੀਦਾ ਬਜ਼ੁਰਗਾਂ ਨੂੰ ਕੋਈ ਮੁਸੀਬਤ ਵੇਲੇ ਜਦੋਂ ਮੁਸੀਬਤ ਆਉਂਦੀ ਹੈ ਉਦੋਂ ਹੀ ਆਪਣਿਆਂ ਦਾ ਪਤਾ ਚੱਲਦਾ ਅਤੇ ਵੱਖਰੇ ਵੱਖਰੇ ਰਹਿ ਕੇ ਕੋਈ ਵਡਿਆਈ ਨਹੀਂ ਹੈਗੀ ਸਾਡੀ ਸਭ ਨੂੰ ਇਕੱਠੇ ਰਹਿਣਾ ਚਾਹੀਦਾ ਆਉਣ ਵਾਲੇ ਟਾਈਮ 'ਚ ਜਿੱਦਾਂ ਅੱਜ ਕੱਲ੍ਹ ਲੋਕ ਕਹਿੰਦੇ ਨੇ ਪਹਿਲੇ ਦੇ ਲੋਕ ਹੋ ਜਾਂਦੇ ਨੇ ਵੱਖਰੇ ਵੱਖਰੇ ਅਸੀਂ ਹੋ ਜਾਈਏ ਅਸੀਂ ਮਾਂ ਪਿਓ ਤੋਂ ਵੱਖਰੇ ਹੋ ਜਾਈਏ ਕ ਇਕੱਲੇ ਹੋ ਜਾਈਏ ਉਦੋਂ ਬੜੇ ਖੁਸ਼ ਹੁੰਦੇ ਜਦੋਂ ਮੁਸੀਬਤ ਵੇਲੇ ਫਿਰ ਯਾਦ ਆਉਂਦੀ ਮਾਂ ਪਿਓ ਦੀ ਫਿਰ ਉਹਨਾਂ ਨੂੰ ਪਤਾ ਚੱਲਦਾ ਕਿ ਸਾਨੂੰ ਮਾਂ ਪਿਓ ਨਾਲ ਹੀ ਰਹਿਣਾ ਚਾਹੀਦਾ ਅਗਰ ਕਿਤੇ ਜਾਣਾ ਵੀ ਹੋਵੇ ਤਾਂ ਮਾਂ ਪਿਓ ਪਿੱਛੋਂ ਧਿਆਨ ਰੱਖਦੇ ਨੇ ਅਗਰ ਨਾਲ ਵੀ ਜਾਣਾ ਬੱਚੇ ਕਿਤੇ ਛੱਡ ਕੇ ਜਾਣੇ ਨੇ ਤਾਂ ਵੀ ਮਾਂ ਪਿਓ ਧਿਆਨ ਰੱਖਦੇ ਸਾਨੂੰ ਇਕੱਠੇ ਹੀ ਰਹਿਣਾ ਚਾਹੀਦਾ ਸਾਨੂੰ ਪੰਛੀਆਂ ਤੋਂ ਇਹ ਸ਼ਿਕਸ਼ਾ ਮਿਲਦੀ ਹੈ ਧੰਨਵਾਦ